ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਸੁਰਜੀਤ ਕੁਮਾਰ ਪਠਾਨਕੋਟ ਤੋਂ ਬੋਲਦਾ ਹਾਂ ਜਿਵੇਂ ਕਿ ਤੁਸੀਂ ਜੀ ਤੁਸੀਂ ਪੁੱਛਿਆ ਹੈ ਕਿ ਭਾਰਤ ਵਿੱਚ ਭੋਜਨ ਕਿਹੋ ਜਿਹਾ ਹੈ ਅਤੇ ਰੋਜ਼ਾਨਾ ਰੋਜ਼ਾਨਾ ਜੀਵਨ ਵਿੱਚ ਬਣਾਏ ਵਰਤੇ ਜਾਣ ਵਾਲੇ ਕੁਝ ਪ੍ਰਸਿੱਧ ਪਕਵਾਨ ਅਤੇ ਮਸ ਮਾਮਲਿਆਂ ਦੀ ਮਾਮਲੇ ਕੀ ਹਨ ਭਾਰਤ ਦੀ ਗੱਲ ਪੁੱਛਣ ਪੁੱਛਣੀ ਅਤੇ ਸਾਡੇ ਭਾਰਤ ਵਿੱਚ ਪੰਜਾਬ ਪੰਜਾਬ ਦੇ ਲੋਕ ਜ਼ਿਆਦਾ ਖਾਸ ਕਰਕੇ ਮੱਕੀ ਦੀ ਰੋਟੀ ਅਤੇ ਸਰਸੋਂ ਦਾ ਸਾਗ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਹਨ ਸਾਡੇ ਪੰਜਾਬ ਵਿੱਚ ਬਹੁਤ ਹੀ ਵਧੀਆ ਸਾਗ ਢੋਲਾ ਹਰ ਘਰ ਮਿਲ ਜਾਂਦਾ ਹੈ ਲੇਕਿਨ ਬਾਤ ਕਰੀਏ ਤਾਂ ਜੰਮੂ ਕਸ਼ਮੀਰ ਦੀ ਇਸ ਦੇਸ਼ ਦੇ ਲੋਕ ਜ਼ਿਆਦਾ ਕਰਕੇ ਭੋਜਨ ਦੀ ਥਾਂ 'ਤੇ ਰਾਜਮਾਂਹ ਚਾਵਲ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਹਾਂ ਜੇ ਸ ਅਸੀਂ ਬਾਤ ਕਰੀਏ ਸਾਊਥ ਦੀ ਇੱਧਰ ਦੇ ਲੋਕ ਤਾਂ ਇਡਲੀ ਡੋਸਾ ਵਗੈਰਾ ਇੱਦਾਂ ਦੇ ਫਾਸਟ ਫੂਡ ਬਹੁਤ ਹੀ ਪਸੰਦ ਕਰਦੇ ਹਨ ਲੇਕਿਨ ਅਸੀਂ ਸਾਡੇ ਪੰਜਾਬ ਵਿੱਚ ਤਾਂ ਮੱਕੀ ਦੀ ਰੋਟੀ ਅਤੇ ਸਰਸੋਂ ਦਾ ਸਾਗ ਉੱਪਰ ਰੱਖਿਆ ਹੋਵੇ ਮੱਖਣ ਬੜਾ ਹੀ ਮਸਤ ਲੱਗਦਾ ਹੈ ਹੋਰ ਵੀ ਚੀਜ਼ਾਂ ਜਿੱਦਾਂ ਕਿ ਲੱਸੀ ਲੱਸੀ ਵੀ ਬਹੁਤ ਵਧੀਆ ਹੁੰਦੀ ਹੈ ਇਹ ਵੀ ਗਰਮੀਆਂ ਦੇ ਦਿਨਾਂ ਵਿੱਚ ਪੀਣ ਨੂੰ ਬੜਾ ਹੀ ਮਜ਼ਾ ਆਉਂਦਾ ਹੈ